ਹਾਂਜੀ ਜਿਵੇਂ ਕਿ ਸਾਡੇ ਖੇਤਰ ਵਿੱਚ ਬਹੁਤ ਹੀ ਅਜਿਹੀਆਂ ਟੀਮਾਂ ਨੇ ਨਾਮਜਦ ਕਿ ਜਿਵੇਂ ਕਿ ਪਿੰਡ ਮਹਿਰਮਪੁਰ ਦੀ ਟੀਮ ਹੋਗੀ ਜੀ ਯੂਥ ਕਲਾਸ ਸੀ ਵੰਨ ਅਤੇ ਇੱਕ ਆਪਣੇ ਲਾਗ ਦੇ ਪਿੰਡ ਮੁਦੋ ਦੀ ਹੋਗੀ ਜੀ ਜਿਵੇਂ ਯੂਥ ਕਲਾਸ ਸੀ ਵੰਨ ਅਤੇ ਇੱਕ ਦੋ ਕੁ ਹੋਰ ਵੀ ਨੇੜਲੇ ਪਿੰਡਾਂ ਦੀਆਂ ਟੀਮਾਂ ਹੈ ਜੀ ਜਿਹਨਾਂ ਬਾਰੇ ਕਿ ਮੈਂ ਜਾਣਦਾ ਹੈ ਜੋ ਕਿ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਖੇਲਦੀਆਂ ਨੇ ਅਤੇ ਡੂਮੈਂਸਟਿਕ ਵੀ ਖੇਲਦੀਆਂ ਨੇ ਇਸ ਨਾਲ਼ ਜਿਵੇਂ ਕਿ ਬਹੁਤ ਹੀ ਨੌਜਵਾਨ ਪ੍ਰੇਰਿਤ ਹੁੰਦੇ ਨੇ ਜੀ ਧੰਨਵਾਦ ਜੀ